ਪਿੱਛੇ ਜਿਹੇ ਮੇਰਾ ਸ਼ਿਮਲੇ ਜਾਣ ਦਾ ਜਦੋਂ ਅਸੀਂ ਮੋਟਰਸਾਈਕਲ 'ਤੇ ਟੂਰ ਕੱਢਿਆ ਸੀਗਾ ਤਿੰਨ ਚਾਰ ਦੋਸਤਾਂ ਨੇ ਉਸ ਤੋਂ ਸਿਹਤ ਲਈ ਬਸ ਮੈਂ ਇਹੀ ਕਿ ਆਪਣਾ ਵੱਧ ਤੋਂ ਵੱਧ ਰਸਤੇ 'ਚ ਰੁਕ ਕੇ ਪਾਣੀ ਪੀਂਦੇ ਸੀ ਆਪਦੀ ਸਿਹਤ ਦਾ ਧਿਆਨ ਰੱਖਦੇ ਸੀਗੇ ਖਾਣਾ ਵੀ ਹਲਕਾ ਫੁਲਕਾ ਖਾਂਦੇ ਸੀਗੇ ਕਿ ਜ਼ਿਆਦਾ ਕੋਈ ਆਪਣਾ ਤਲਿਆ ਹੋਇਆ ਪੂਰੀਆਂ ਪਾਰੀਆਂ ਤੋਂ ਅਵਾਈਡ ਕਰਦੇ ਸੀ ਕਿਉਂਕਿ ਪਹਾੜਾਂ ਵਾਲਾ ਜਿਹੜਾ ਰਸਤਾ ਸੀ ਉਬੜ ਖਾਬੜ ਦਾ ਸੀਗਾ ਉੱਥੋਂ ਕਈ ਵਾਰ ਐਂ ਹੁੰਦਾ ਕਿ ਕਿਤੇ ਵੋਮਟਿੰਗ ਜਾਂ ਕੋਈ ਚੱਕਰ ਆਉਣ ਨਾ ਲੱਗ ਜਾਣ ਉਸ ਦੇ ਪਰਹੇਜ਼ 'ਚ ਅਸੀਂ ਅਤੇ ਜਦੋਂ ਵੀ ਸਾਡਾ ਮਨ ਜਿਹਾ ਸਾਡਾ ਲੱਗਦਾ ਸੀਗਾ ਕਈ ਵਾਰ ਖਰਾਬ ਹੁੰਦਾ ਫਿਰ ਅਸੀਂ ਰੋਕ ਲੈਂਦੇ ਸੀਗੇ ਕਈ ਵਾਰ ਜੇ ਮੰਨ ਲਉ ਹੁਣ ਬਰਸਾਤ ਹੋਣ ਲੱਗ ਜਾਂਦੀ ਵੈਸੇ ਅਸੀਂ ਬਰਸਾਤੀ ਨਾਲ ਚੱਕੀਆਂ ਹੋਈਆਂ ਸੀਗੀਆਂ ਪਰ ਫਿਰ ਵੀ ਅਸੀਂ ਪ੍ਰੈਫਰ ਕਰਦੇ ਸੀ ਕਿਤੇ ਨਾ ਕਿਤੇ ਰੋਕ ਲੈਂਦੇ ਸੀਗੇ ਜਦੋਂ ਮੀਂਹ ਹਟ ਜਾਂਦਾ ਕਿਉਂਕਿ ਜੇ ਨਾ ਰੁਕਦੇ ਚਲੋ ਬਰਸਾਤੀ ਵੀ ਲਈ ਹੁੰਦੀ ਮੋਟਰਸਾਈਕਲ 'ਤੇ ਬ ਆਪਣੇ ਬੂਟ ਬਾਟ ਖਰਾਬ ਹੋ ਜਾਂਦੇ ਪਰ ਉਹਨੂੰ ਅਸੀਂ ਆਪਦਾ ਬਚਾਅ ਹੀ ਰੱਖਦੇ ਸੀਗੇ ਕਿ ਰੋਕ ਲੈਂਦੇ ਸੀਗੇ ਹਾਂ ਇਹ ਸਫਰ ਦੇ ਵਿੱਚ ਵਿੱਚ ਜ਼ਰੂਰ ਆਪਣੀ ਪਿੱਠ ਦਰਦ ਜਾਂ ਕੋਈ ਮੋਢੇ ਦਰਦ ਥੋੜ੍ਹਾ ਥੋੜ੍ਹਾ ਹੋ ਜਾਂਦਾ ਸੀ ਜਦੋਂ ਤੇਜ਼ ਤੋਰਦੇ ਸੀਗੇ ਐਡਾ ਸਫਰ 'ਚ ਪਰ ਹੌਲੀ ਹੌਲੀ ਤੋਰ ਲੈਂਦੇ ਸੀ ਵਿੱਚ ਕਰ ਲੈਂਦੇ ਸੀਗੇ ਐਡਜਸਟਮੈਂਟ ਪਰ ਬਹੁਤ ਵਧੀਆ ਲੱਗਿਆ ਹੈ ਸਫਰ 'ਤੇ ਅੱਗੇ ਤੋਂ ਬਸ ਜਿਹੜੀਆਂ ਚੀਜ਼ਾਂ ਦੀ ਕਮੀਆਂ ਨਾਲ ਦ ਦਵਾਈ ਬੂਟੀ ਲੈ ਕੇ ਨਾਲ ਤੁਰੇ ਹੋਏ ਸੀ ਅਸੀਂ ਅਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਜੀ